ਸਾਨੂੰ ਇਕੱਠੇ ਕੰਮ ਕਰਦੇ ਹੋਏ ਸਮਾਂ ਤਾਂ ਕਾਫ਼ੀ ਹੋ ਗਿਆ ਸੀ ਲੇਕਿਨ ਸਾਡਾ ਸੁਭਾਅ ਆਪਸ ਵਿੱਚ ਨਹੀਂ ਮਿਲਿਆ ਜਿਸ ਕਾਰਨ ਜਿਸ ਕਾਰਨ ਸਾਨੂੰ ਇਕੱਠੇ ਕੰਮ ਕਰਨ ਦਾ ਕੋਈ ਆਨੰਦ ਨਹੀਂ ਸੀ ਆਉਂਦਾ ਇਸ ਕਰਕੇ ਮੈਂ ਸਮਾਂ ਪੈਣ ਦੇ ਨਾਲ ਹੀ ਸਾਨੂੰ ਕੰਮ ਕਰਨ ਦੇ ਵਿੱਚ ਮਜ਼ਾ ਆਨੰਦ ਨਹੀਂ ਸੀ ਆ ਰਿਹਾ ਅਤੇ ਮੈਂ ਕੰਮ ਕਰਦੇ ਕਰਦੇ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਇਕੱਠੇ ਕੰਮ ਕਰੀਏ ਲੇਕਿਨ ਸਾਨੂੰ ਕੰਮ ਦਾ ਮਜ਼ਾ ਨਹੀਂ ਸੀ ਆਉਂਦਾ ਵਰਕ ਲੋਡ ਜ਼ਿਆਦਾ ਸੀਗਾ ਇਸ ਕਰਕੇ ਕੰਮ ਸ਼ਾਮ ਨੂੰ ਕਰਕੇ ਪੂਰਾ ਦੇਨ ਦੇਣਾ ਪੈਨ ਪੈਂਦਾ ਸੀਗਾ ਕਾਫ਼ੀ ਸੀਨੀਅਰ ਨਾਲ ਵੀ ਗੱਲ ਕਰੀ ਲੇਕਿਨ ਮੈਨੂੰ ਕੋਈ ਵਧੀਆ ਰਿਸਪੌਂਸ ਕੋਈ ਵਧੀਆ ਉੱਪਰੋਂ ਰਿਸਪੌਂਸ ਨਾ ਮਿਲਣ ਕਰਕੇ ਮੈਂ ਕੰਮ ਛੱਡਣ ਵਿੱਚ ਹੀ ਆਪਣੀ ਭਲਾਈ ਸਮਝੀ ਔਰ ਮੈਨੂੰ ਹੋਰ ਕੰਪਨੀ 'ਚ ਇਸ ਤੋਂ ਵਧੀਆ ਕੰਮ ਮਿਲ ਗਿਆ ਅਤੇ ਹੁਣ ਸਾਡੇ ਵਰਕਰ ਕੰਮ ਨੂੰ ਛੱਡ ਕੇ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਨ ਅਤੇ ਅਸੀਂ ਬਹੁਤ ਵਧੀਆ ਕੰਮ ਇਕੱਠੇ ਹੋ ਕੇ ਕਰ ਰਹੇ ਹਾਂ ਕੰਮ ਕਰਨ ਵਿੱਚ ਆਨੰਦ ਆਉਂਦਾ ਹੈ ਵਧੀਆ ਲਗਦਾ ਹੈ ਕੰਮ ਕਰਨਾ ਔਰ ਸਾਨੂੰ ਕਦੇ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਦਫ਼ਤਰ ਵਿੱਚ ਵਰਕਰਾਂ ਨਾਲ ਕੰਮ ਕਰ ਰਹੇ ਹਾਂ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਆਪਣੇ ਭੈਣ ਭਾਈ ਨਾਲ ਹੀ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਹਾਂ ਔਰ ਸਾਨੂੰ ਕੰਮ ਵਿੱਚ ਬਹੁਤ ਬਰਕਤ ਮਿਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ